ਬਾਰ੍ਹਾਂ ਮਾਰਚ ਉਨੀ ਸੌ ਛਿਆਨਵੇਂ ਇੱਕੀ ਮਾਰਚ ਉਨੀ ਸੌ ਅਠਾਨਵੇਂ ਗਿਆਰ੍ਹਾਂ ਸਤੰਬਰ ਉਨੀ ਸੌ ਸਤਾਨਵੇਂ ਛੇ ਜੁਲਾਈ ਉੱਨੀ ਸੌ ਚੁਰਾਨਵੇਂ ਚੌਵੀ ਜਨਵਰੀ ਉਨੀ ਸੌ ਪਚਾਨਵੇਂ